ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਪਰ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਪਰ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ ਜੀ ਹਾਂਜੀ ਠੀਕ ਆ ਜੀ ਤੁਹਾਨੂੰ ਮੇਰੇ ਤੋਂ ਕਿਆ ਜਾਣਕਾਰੀ ਚਾਹੀਦੀ ਹੈ ਜੀ ਹਾਂਜੀ ਇੱਥੇ ਵੈਸੇ ਬਹੁਤ ਸਾਰੀਆਂ ਦੁਕਾਨਾਂ ਇੱਥੇ ਮਸ਼ਹੂਰ ਆ ਜਿਹੜੀਆਂ ਪਰ ਜਿਹੜੀਆਂ ਜ਼ਿਆਦਾ ਅ ਵਧੀਆ ਏ ਔਰ ਜਿਹੜੀਆਂ ਜ਼ਿਆਦਾ ਜਿੱਥੇ ਲੋਕ ਜਾਂਦੇ ਹੈ ਉਹ ਜਿਵੇਂ ਹੋ ਗਈਆਂ ਚੰਡੀਗੜ੍ਹ ਸਵੀਟਸ ਹੋ ਗਈ ਗੋਪਾਲ ਸਵੀਟਸ ਹੋ ਗਈ ਵਿਰਾਟ ਸਵੀਟਸ ਹੋ ਗਈ ਇਹ ਜ਼ਿਆਦਾ ਇੱਥੇ ਮਸ਼ਹੂਰ ਹੈ ਮੋਹਾਲੀ 'ਚ ਮੋਹਾਲੀ ਜ਼ਿਲ੍ਹੇ ਵਿੱਚ ਲੋਕ ਇਹਨਾਂ 'ਤੇ ਹੀ ਜ਼ਿਆਦਾ ਜਾਂਦੇ ਹੈ ਇਹਨਾਂ ਦੀਆਂ ਮਠਿਆਈਆਂ ਹੀ ਜ਼ਿਆਦਾ ਪਸੰਦ ਕਰਦੇ ਹੈ ਹਾਂਜੀ ਹਾਂਜੀ ਪਰ ਇਹਦੇ ਬਾਰੇ ਮੈਨੂੰ ਜ਼ਿਆਦਾ ਪ ਪਤਾ ਨਹੀਂ ਹੈ ਵੀ ਉਹ ਇਜਾਜ਼ਤ ਦੇਣਗੇ ਜਾਂ ਨਹੀਂ ਦੇਣਗੇ ਇਹ ਤਾਂ ਉੱਥੇ ਜਾ ਕੇ ਹੀ ਪਤਾ ਚੱਲੇਗਾ ਕਿ ਉਹ ਇਸ ਦੇ ਬਾਰੇ ਤੁਹਾਨੂੰ ਪਰਮੀਸ਼ਨ ਦੇਣਗੇ ਜਾਂ ਨਹੀਂ ਹਾਂਜੀ ਕੋਈ ਨਹੀਂ ਤੁਸੀਂ ਕੱਲ ਨੂੰ ਆ ਜਿਉ ਆਪਾਂ ਚੱਲਾਂਗੇ ਜੀ ਪਤਾ ਕਰ ਲਵਾਂਗੇ ਕਿ ਉਹ ਇਜਾਜ਼ਤ ਦੇ ਦੇਣਗੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਓ